ਹੈਲੋ ਹੈਲੋ ਹੈਲੋ ਹੈਲੋ ਮੈਮ ਆਵਾਜ਼ ਆ ਰਹੀ ਹੈ ਹੈਲੋ ਚਲੋ ਫੇਰ ਸਟਾਰਟ ਕਰੋ ਹਾਂਜੀ ਹੋਰ ਕੀ ਹਾਲ ਚਾਲ ਹਾਂਜੀ ਵਧੀਆ ਜੀ ਹੋਰ ਕੀ ਕਰਦੇ ਪਏ ਸੀ ਅੱਛਾ ਦੀਦੀ ਤੁਸੀਂ ਰਮਨ ਨੂੰ ਕਿੱਥੇ ਪਾਇਆ ਕਿਹੜੇ ਸਕੂਲ ਪਾਇਆ ਏ ਅੱਛਾ ਸੀ ਬੀ ਐਸ ਈ ਸਕੂਲ 'ਚ ਪਾਇਆ ਕਿੱਦਾਂ ਦਾ ਸਕੂਲ ਹੈ ਸੀ ਬੀ ਐਸ ਈ ਫੇਰ ਹਾਂਜੀ ਦੀਦੀ ਮੈਂ ਤਾਂ ਸੋਚਦੀ ਪਈ ਸੀ ਪੰਜਾਬ ਬੋਰਡ 'ਚ ਪਾਵਾਂ ਕਹਿੰਦੇ ਪੰਜਾਬ ਬੋਰਡ ਬਹੁਤ ਵਧੀਆ ਹੈਗਾ ਉੱਥੇ ਪੜ੍ਹਾਈ ਬੜੀ ਵਧੀਆ ਹੈਗੀ ਆ ਸੀ ਬੀ ਐਸ ਈ ਦੇ ਨਾਲੋਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜ ਹਾਂਜੀ ਮੈਮ ਦੀਦੀ ਕਹਿੰਦੇ ਹੈ ਕਿ ਨਹੀਂ ਪੰਜਾਬ ਬੋਰਡ ਪਾਓ ਅਸੀਂ ਵੀ ਪੰਜਾਬ ਬੋਰਡ ਹੀ ਪੜ੍ਹੇ ਹੋਏ ਆ ਉਹਨੂੰ ਉਹ ਪੜ੍ਹਾਈ ਵੀ ਇੰਗਲਿਸ਼ ਮੀਡੀਅਮ ਹੋ ਗਈ ਹੈ ਅਤੇ ਹੁਣ ਅਸੀਂ ਸੋਚਦੇ ਪਏ ਕਿ ਪੰਜਾਬ ਬੋਰਡ ਪਾ ਦੇਈਏ ਪਰ ਨਾਲ ਖਰਚਾ ਵੀ ਤੁਹਾਨੂੰ ਪਤਾ ਹੀ ਆ ਸੀ ਬੀ ਐਸ ਈ ਦਾ ਕਿੰਨਾ ਜ਼ਿਆਦਾ ਕਿੰਨੀਆਂ ਐਕਟੀਵਿਟੀ ਕਰਵਾਉਂਦੇ ਹੈਗੇ ਬੱਚਿਆਂ ਨੂੰ ਅਸੀਂ ਕਿੱਦਾਂ ਦੇ ਸਕਦੇ ਹੈਗੇ ਇੰਨੀ ਦੇ ਸਕਦੇ ਹਾਂ ਅਸੀਂ ਹਾਂਜੀ ਅੱਛਾ ਜੀ ਠੀਕ ਹੈ ਜੀ ਓਕੇ ਓਕੇ ਬਾਏ ਜੀ ਬਾਏ